ਜਿਸ ਸਕੂਲ ਵਿੱਚ ਮੈਂ ਪੜ੍ਹਦਾ ਸੀ ਉਸ ਸਕੂਲ ਵਿੱਚ ਇੱਕ ਲਾਇਬਰੇਰੀ ਸੀ ਕਿਤਾਬਾਂ ਪੜ੍ਹਨ ਦਾ ਮੈਨੂੰ ਸ਼ੁਰੂ ਤੋਂ ਹੀ ਬਹੁਤ ਸ਼ੌਕ ਰਿਹਾ ਹੈ ਇਸ ਕਰਕੇ ਮੈਨੂੰ ਜਦ ਵੀ ਮੌਕਾ ਮਿਲਦਾ ਮੈਂ ਲਾਇਬਰੇਰੀ ਵਿੱਚ ਚਲਾ ਜਾਂਦਾ ਅਤੇ ਉੱਥੇ ਬੈਠ ਕੇ ਕੋਈ ਨਾ ਕੋਈ ਕਿਤਾਬ ਕੱਢ ਕੇ ਪੜ੍ਹਨ ਲੱਗ ਜਾਂਦਾ ਚੰਗੀਆਂ ਕਿਤਾਬਾਂ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਹਮੇਸ਼ਾ ਚੰਗੀ ਸੇਧ ਦਿੰਦੀਆਂ ਹਨ ਮੈਂ ਜੋ ਕਿਤਾਬਾਂ ਆਪਣੇ ਐਜੂਕੇਸ਼ਨ ਦੌਰਾਨ ਸਕੂਲ ਕਾਲਜ ਦੀ ਲਾਈਫ ਦੌਰਾਨ ਪੜ੍ਹੀਆਂ ਉਹਨਾਂ ਵਿੱਚ ਇੱਕ ਕਿਤਾਬ ਜੋ ਮੈਨੂੰ ਇੱਕ ਪ੍ਰਾਈਜ ਦੇ ਰੂਪ ਵਿੱਚ ਮਿਲੀ ਉਹ ਸੀ ਇੰਗਲਿਸ਼ ਸਪੀਕਿੰਗ ਕੋਰਸ ਇਸ ਤੋਂ ਇਲਾਵਾ ਤਿੰਨ ਚਾਰ ਕਿਤਾਬਾਂ ਹੋਰ ਸਨ ਜੋ ਸਾਰੀਆਂ ਮੈਨੂੰ ਪ੍ਰਾਈਜ ਵਿੱਚ ਮਿਲੀਆਂ ਸਨ ਉਹਨਾਂ ਵਿੱਚ ਇੱਕ ਇੰਗਲਿਸ਼ ਦੀ ਕਿਤਾਬ ਸੀ ਜਿਹਦਾ ਨਾਂ ਸੀ ਟਰਨ ਔਨ ਦਾ ਗ੍ਰੀਨ ਲਾਈਟਸ ਇੰਨ ਯੂਅਰ ਲਾਈਫ ਇਸ ਤਰ੍ਹਾਂ ਇੱਕ ਹੋਰ ਕਿਤਾਬ ਸੀ ਜਿਹਦਾ ਨਾਂ ਸੀ ਦਾ ਪਾਵਰ ਔਫ ਪੋਜ਼ੀਟਿਵ ਥਿੰਕਿੰਗ ਮੈ ਪ੍ਰਾਈਜ ਵਿੱਚ ਪੰਜ ਕਿਤਾਬਾਂ ਲਈਆਂ ਸਨ ਜਿਨ੍ਹਾਂ ਵਿੱਚ ਇੱਕ ਇੰਗਲਿਸ਼ ਸਪੀਕਿੰਗ ਕੋਰਸ ਦੂਸਰੀ ਦਾ ਪਾਵਰ ਔਫ ਪੋਜ਼ੀਟਿਵ ਥਿੰਕਿੰਗ ਤੀਸਰੀ ਟਰਨ ਔਨ ਦਾ ਗ੍ਰੀਨ ਲਾਈਟਸ ਇੰਨ ਯੂਅਰ ਲਾਈਫ ਇੱਕ ਪੰਜਾਬੀ ਦੀ ਕਿਤਾਬ ਰਸੋਈ ਸਿੱਖਿਆ ਵੀ ਮੈਂ ਉਹਨਾਂ ਪ੍ਰਾਈਜ ਦੀਆਂ ਕਿਤਾਬਾਂ ਵਿੱਚ ਲਈ ਸੀ ਅਤੇ ਇਸ ਤੋਂ ਇਲਾਵਾ ਇੱਕ ਪੰਜਾਬੀ ਨਾਵਲ ਸੀ ਜਿਹਦਾ ਨਾਂ ਹੈ ਸਿਵਲ ਲਾਈਨਜ